ਹੈਲੋ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸੁਰਿੰਦਰ ਕੌਰ ਬੋਲਦੀ ਹਾਂ ਜੀ ਮੈਂ ਠੀਕ ਹੈ ਜੀ ਤੁਸੀਂ ਸੁਣਾਓ ਕਿਆ ਹਾਲ ਹੈ ਬਸ ਯਾਰ ਮੈਨੂੰ ਜ਼ਰੂਰਤ ਹੈ ਕੋਈ ਕੁਛ ਸਾਰੇ ਠੀਕ ਹੈ ਤੁਸੀਂ ਸੁਣਾਓ ਤੁਹਾਡੇ ਬੱਚੇ ਠੀਕ ਹੈ ਬਸ ਮੈਂ ਬਸ ਠੀਕ ਹੈ ਥੋੜ੍ਹੀ ਤਬੀਅਤ ਜੀ ਖਰਾਬ ਚੱਲ ਰਹੀ ਤੀ ਹੁਣ ਤਾਂ ਪਰ ਠੀਕ ਹੈ ਹਾਂ ਮੈਂ ਨਾ ਹਾਂ ਬਸ ਮੈਨੂੰ ਸੇਵਾ ਮੈਂ ਤੁਹਾਡੇ ਤੋਂ ਸੂਟ ਖਰੀਦਣਾ ਇੱਕ ਹਮ ਇੱਕ ਮੈ ਮੈਰਿਜ 'ਤੇ ਜਾਣਾ ਹੈ ਕੁਛ ਪਾਰਟੀ ਵੇਅਰ ਚਾਹੀਦਾ ਹੈ ਚੁਆਇਸ ਮਤਲਬ ਕਲਰ ਹੋਵੇ ਪਿੰਕ ਰੇਂਜ ਹੋਵੇ ਪੰਦਰ੍ਹਾਂ ਕੁ ਸੋ ਤੱਕ ਦੇਖ ਲਿਓ ਹਮ ਹਮ ਹਮ ਹਮ ਮੈਨੂੰ ਚਾਹੀਦਾ ਪਾਰਟੀ ਵੇਅਰ ਮਤਲਬ ਸਿਲਕ ਦਾ ਹੋਵੇ ਮੈਰਿਜ 'ਤੇ ਜਾਣਾ ਹੈ ਨਾ ਕਢਾਈ ਹਮ ਕਢਾਈ ਵਾਲਾ ਹਾਂਜੀ ਹੋਰ ਕੁਛ ਬਸ ਪਹਿਲਾ ਚੁੰਨੀ ਸੂਟ ਦੇ ਨਾਲ ਨਹੀਂ ਹੋਵੇਗੀ ਆਹਾਂ ਹਾਂ ਅੱਛਾ ਤੁ ਤੁਸੀਂ ਐਵੇਂ ਕਰਿਓ ਜਿਹਦੇ ਨਾਲ ਚੁੰਨੀ ਹੋਵੇ ਨਾ ਮਤਲਬ ਕਢਾਈ ਵਾਲੀ ਉਹ ਵਾਲਾ ਹੀ ਸੂਟ ਦਿਓ ਤੁਸੀਂ ਮੈਨੂੰ ਕਲਰ ਪਿੰ ਕਲਰ ਪਿੰਕ ਹੀ ਹੋਵੇ ਜੁੱਤੀ ਚਾਹੀਦੀ ਹੈ ਮੈਨੂੰ ਹੈਗੀਆਂ ਅੱਛਾ ਅੱਛਾ ਜੁੱਤੀ ਜੁੱ ਅੱਛਾ ਅੱਛ ਅੱਛਾ ਚੱਲੋ ਮੈਂ ਅੱਛਾ ਚੱਲੋ ਮੈਂ ਪੰਜਾਬੀ ਜੁੱਤੀ ਲੈ ਲੂੰਗੀ ਬਾਕੀ ਕੋਈ ਆਰਟੀਫਿਸ਼ਲ ਸੈੱਟ ਦੇ ਸੈੱਟ ਵੀ ਆ ਕੇ ਸੂਟ ਨਾਲ ਮਿਲਾ ਕੇ ਨਾ ਫਿਰ ਮੈਂ ਲੈ ਲੂੰਗੀ ਮੈਚਿੰਗ ਕਰਕੇ ਕਲਰ ਪਿੰਕ ਚਾਹੀਦਾ ਹੈ ਕਢਾਈ ਵਾਲਾ ਹੋਵੇ ਨਾਲ ਦੁਪੱਟੇ ਦੇ ਵੀ ਕਢਾਈ ਹੋਵੇ ਕਿਉਂਕਿ ਹੁਣ ਅਲੱਗ ਤੇ ਕੌਣ ਲੈਸ ਖਰੀਦਦਾ ਫਿਰੂਗਾ ਫਿਰ ਲਗਾਓ ਐਨਾ ਟਾਈਮ ਨਹੀਂ ਹੈਗਾ ਫਿਰ ਹਾਂਜੀ ਠੀਕ ਹੈ ਫਿਰ ਦੇਖ ਕੇ ਆ ਕੇ ਸਤਿ ਸ਼੍ਰੀ ਅਕਾਲ ਜੀ